ਜੇ ਤੁਸੀਂ ਉੜੀਸਾ ਵਿੱਚ ਗਾਹਕ ਨੂੰ ਸੇਵਾਵਾਂ ਦੇ ਰਹੇ ਹੋ ਤਾਂ ਜੀ ਐਸ ਟੀ ਦੇ ਨਿਯਮਾਂ ਦੇ ਅਨੁਸਾਰ ਤੁਸੀਂ ਟੈਕਸ ਦੇ ਭੁਗਤਾਨ ਲਈ ਜਿੰਮੇਵਾਰ ਹੋ ਸਕਦੇ ਹੋ ਪਰ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਸੇਵਾਵਾਂ ਕਿੱਥੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਅਤੇ ਇਹ ਕਿਸ ਕਿਸਮ ਦੀਆਂ ਸੇਵਾਵਾਂ ਹਨ ਸਰਹੱਦ ਪਾਰ ਸੇਵਾਵਾਂ ਲਈ ਇਹ ਚੰਗਾ ਹੈ ਕਿ ਤੁਸੀਂ ਆਪਣੀ ਸਹਿਯੋਗ ਨਾਲ ਇਸ ਬਾਰੇ ਗੱਲ ਕਰਦੇ ਹੋ ਕਿ ਕਿਹੜੀ ਸੇਵਾਵਾਂ ਐਕਸਪ੍ਰੋਟ ਅਤੇ ਅਤਿਰਿਕਤ ਆਉਂਦੀਆਂ ਹਨ ਅਤੇ ਇਹੋ ਜੀ ਐਸ ਟੀ ਤੋਂ ਮੁਕਤ ਹੋ ਸਕਦੀਆਂ ਹਨ ਜਾਂ ਨਹੀਂ ਇਸ ਦੇ ਨਾਲ ਨਾਲ ਟੈਕਸ ਦੇ ਵਿਰਪਨ ਮਿਤੀਆਂ ਅਤੇ ਟੈਲੀਫੋਸੈਕਸਨ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੁੰਦਾ ਹੈ ਕਿ ਤੁਹਾਡੇ ਕੋਲ ਕੋਈ ਵਿਸ਼ੇਸ਼ ਸਵਾਲ ਹੈ ਜਾਂ ਤੁਸੀਂ ਕਿਸੇ ਖ਼ਾਸ ਸੇਵਾ ਬਾਰੇ ਜਾਣਕਾਰੀ ਚਾਹੁੰਦੇ ਹੋ ਜਦੋਂ ਤੁਸੀਂ ਵਿਦੇਸ਼ਾਂ ਵਿੱਚ ਗਾਹਕ ਨੂੰ ਸਵੇਬ ਪ੍ਰਦਾਨ ਕਰਦੇ ਹੋ ਤਾਂ ਇਹ ਸਮਝਣਾ ਜ਼ਰੂਰੀ ਹੈ ਕਿ ਜੀ ਐਸ ਟੀ ਦੇ ਨਿਯਮ ਅਨੁਸਾਰ ਬਹੁ ਸੇਵਾਵਾਂ ਦਾ ਟੈਕਸ ਲਾਗੂ ਹੋ ਸਕਦਾ ਹੈ ਜਾਂ ਨਹੀਂ ਐਕਸਪਰੋਟ ਸੇਵਾਵਾਂ ਜੇਕਰ ਤੁਹਾਡੀਆਂ ਸੇਵਾਵਾਂ ਨੂੰ ਐਕਸਪਰੋਟ ਸੇਵਾਵਾਂ ਦੇ ਤੌਰ 'ਤੇ ਦਰਜ ਕੀਤਾ ਜਾਂਦਾ ਹੈ ਤਾਂ ਇਹ ਆਮ ਤੌਰ 'ਤੇ ਜੀ ਐਸ ਟੀ ਤੋਂ ਮੁਕਤ ਹੁੰਦੀਆਂ ਹਨ ਸੇਵਾ ਦੀ ਕਿਸਮ ਇਹ ਵੀ ਦੇਖਦੇ ਹਨ ਚਾਹੁੰਦੇ ਹਨ ਕਿ ਕੀ ਤੁਸੀਂ ਕਿਹੜੀਆਂ ਸੇਵਾਵਾਂ ਦੇ ਰਹੇ ਹੋ ਜਿਵੇਂ ਕਿ ਪ੍ਰਦਰਸ਼ਨ ਐਪਟਨ ਜਮੈਟ ਜਾਂ ਹੋਰ ਸੇਵਾਵਾਂ ਕਿਉਂਕਿ ਇਹਨਾਂ ਦੀਆਂ ਮਿਆਦਾਂ 'ਤੇ ਲਾਗੂ ਹੋਣ ਵਾਲੇ ਨਿਯਮ ਵੱਖਰੇ ਹੋ ਸਕਦੇ ਹਨ ਟੈਕਸ ਸਟੇਟ ਇਹ ਹੀ ਜਾਨਣਾ ਮਹੱਤਵਪੂਰਨ ਹੈ ਕਿ ਸੇਵਾਵਾਂ ਪ੍ਰਦਾਨ ਕਰਨ ਵਾਲਾ ਵਿਅਕਤੀ ਜਾਂ ਸੰਸਥਾ ਮੌਜੂਦ ਜੀ ਐਸ ਟੀ ਜੀਡੇਸ਼ਨ ਦੇ ਤਹਿਤ ਹੈ ਜਾਂ ਨਹੀਂ ਰਿਪੋਰਟਿੰਗ ਅਤੇ ਦਸਤਾਵੇਜ਼ ਅਤੇ ਤੁਸੀਂ ਆਪਣੇ ਵਪਾਰ ਦੇ ਲਈ ਸਹੀ ਦਸਤਾਵੇਜ਼ ਬਣਾਓ ਅਤੇ ਰਿਪੋਰਟਿੰਗ ਕਰਨ ਦੀ ਯਕੀਨ ਬਣਾਉਣਾ ਚਾਹੁੰਦੇ ਹੋ ਤਾਂ ਜੋ ਕਿਸੇ ਵੀ ਆਮਦਨ ਨੂੰ ਦਰਜ ਕੀਤਾ ਜਾ ਸਕੇ ਸਹਿਯੋਗ ਨਾਲੇ ਇਸ ਬਾਰੇ ਚਰਚਾ ਕਰਦੇ ਹੋਏ ਉਹਨਾਂ ਵਿਸਤਾਰ ਨਿਯਮ ਅਤੇ ਮਿਆਦ ਦੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਜੋ ਕਿ ਤੁਹਾਡੇ ਕੰਮ ਨੂੰ ਪ੍ਰਭਾਵਿਤ ਕਰ ਸਕਦੇ ਹਨ